ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਦੱਸੋ ਜੀ ਹਾਂਜੀ ਹਾਂਜੀ ਹਾਂਜੀ ਦੱਸੋ ਜ਼ਰੂਰ ਅੱਛਾ ਜੀ ਅੱਛਾ ਜੀ ਅੱਛਾ ਜੀ ਓਕੇ ਅਗਰ ਘਰ ਵਿੱਚ ਬੱਚੇ ਛੋਟੇ ਨੇ ਤੁਹਾਡੇ ਤਾਂ ਤਾਂ ਫਿਰ ਤੁਸੀਂ ਕੋਈ ਵਾਲਪੇਪਰ ਵਗੈਰਾ ਹੀ ਲਗਾ ਸਕਦੇ ਓ ਤਾਂ ਕੀ ਬੱਚੇ ਕੋਈ ਨੁਕਸਾਨ ਨਾ ਪਹੁੰਚਾਉਣ ਕਿਉਂਕਿ ਪੀ ਵੀ ਸੀ ਸ਼ੀਟ ਵਿੱਚ ਤਾਂ ਬੱਚੇ ਪਹੁੰਚਾਈ ਸਕਦੇ ਹੈ ਹਾਂਜੀ ਜਾ ਟਾਈਲਸ ਵਗੈਰਾ ਹੈਗੀਆਂ ਸੀਮਿਟ ਦੀਆਂ ਉਹ ਦੇ 'ਤੇ ਅੱਛੇ ਰੰਗ ਵਗੈਰਾ ਕਰਕੇ ਅੱਛੇ ਡਿਜ਼ਾਇਨਰ ਹੋ ਸਕਦੀ ਤੁਸੀਂ ਕਿਸ ਸਾਈਡ ਤੋਂ ਬੋਲ ਰਹੇ ਹੋ ਕੀ ਕੀ ਐਡਰੈਸ ਹੈ ਤੁਹਾਡਾ ਅੱਛਾ ਜੀ ਸਿਵਲ ਲਾਈਨ ਵਿੱਚ ਤਾਂ ਨਹੀਂ ਹੋਇਆ ਹੋਇਆ ਕੰਮ ਚੁੱਲੇ ਲਾਲ ਕਲੋਨੀ ਵਿੱਚ ਹੀ ਹੋਇਆ ਇੱਕ ਦੋ ਸਾਈਡ 'ਤੇ ਤੁਸੀਂ ਉਹਨਾਂ ਦੇ ਘਰ ਜਾ ਕੇ ਦੇਖ ਸਕਦੇ ਹੋ ਪੁੱਛ ਸਕਦੇ ਹੋ ਕਿੱਦਾਂ ਦਾ ਕੰਮ ਕੀਤਾ ਕਿਵੇਂ ਉਹਨਾਂ ਦੇ ਵਿਊਜ਼ ਲੈ ਸਕਦੇ ਹਾਂਜੀ ਹਾਂਜੀ ਸਾਰਾ ਸਾ ਸਾਰਾ ਕੰਮ ਹੈ ਸਾਡੀ ਦੁਕਾਨ 'ਤੇ ਭਾਜੀ ਹਾਂਜੀ ਤੁਸੀਂ ਅਗਰ ਤੁਹਾਡੇ ਕੋਲ ਕੁਛ ਡਿਜ਼ਾਇਨ ਵਗੈਰਾ ਹੋਏਗਾ ਤੁਸੀਂ ਕੁਛ ਫੋਟੋ ਕਲਿਕ ਕੀਤੀ ਹੋਏਗੀ ਸਭ ਬਸ ਉਵੇਂ ਹੀ ਦੇਖ ਕੇ ਕਰ ਦਿੰਦੇ ਹਾਂ ਹਾਂਜੀ ਹਾਂਜੀ ਇਕਦਮ ਤੁਹਾਨੂੰ ਕਰੈਕਟ ਕਰਕੇ ਦਿਆਂਗੇ ਕੰਮ ਅਸੀਂ ਵੀ ਤੁਹਾਨੂੰ ਕੁਛ ਫੋਟੋਆਂ ਹਾਂਜੀ ਸਾਰਾ ਹੋ ਜਾਵੇਗਾ ਜੀ ਕੋਈ ਵੀ ਘਰ ਵਿੱਚ ਕਿਤੇ ਵੀ ਕਰਵਾਉਣਾ ਰਸੋਈ ਤੋਂ ਲੈ ਕੇ ਸਾਰਾ ਹਾਂਜੀ ਹਾਂ ਹਾਂਜੀ ਤੁਸੀਂ ਇੱਦਾਂ ਕਰੋ ਸਾਡੀ ਦੁਕਾਨ 'ਤੇ ਇੱਥੇ ਆ ਹਾਂ ਹਾਂਜੀ ਸਭ ਮਿਲੇਗਾ ਤੁਸੀਂ ਇੱਦਾਂ ਕਰੋ ਸਾਡੀ ਦੁਕਾਨ 'ਤੇ ਆ ਜਾਓ ਤੁਹਾਨੂੰ ਕੁਛ ਡਿਜ਼ਾਇਨ ਦਿਖਾ ਦਿੰਦੇ ਹਾਂ ਤੁਸੀਂ ਸਲੈਕਟ ਕਰ ਲੈਣਾ ਅਗਰ ਤੁਹਾਨੂੰ ਕੁਛ ਆਉਂਦੇ ਹੈ ਪਸੰਦ ਤਾਂ ਕੁਛ ਘਰਾਂ ਵਿੱਚ ਵੀ ਕੰਮ ਕੀਤਾ ਉਹਨਾਂ ਦੀ ਵੀ ਹੈਗੀਆਂ ਫੋਟੋਸ ਸਭ ਦਿਖਾ ਦਿੰਦੀ ਹਾਂ ਤੁਹਾਨੂੰ ਹਾਂਜੀ ਹਾਂਜੀ ਉਹ ਡਿਜ਼ਾਇਨ ਦੇ ਅਕੋਰਡਿੰਗ ਹੀ ਹੈ ਜਿੱਦਾਂ ਦਾ ਡਿਜ਼ਾਇਨ ਹੋਏਗਾ ਉੱਦਾਂ ਹੀ

ਹਾਂਜੀ ਹਾਂਜੀ ਹਾਂਜੀ ਫਲੋਰਿੰਗ ਦਾ ਵੀ ਕਰਵਾ ਲਓ ਹੁਣ ਨਾਲੇ ਦਸ ਸਾਲ ਦੀ ਗਰੰਟੀ ਹੁੰਦੀ